ਗਾਵਾਂ ਵਿੱਚ ਮਿਲਕ ਫੀਵਰ ਦੀ ਬਿਮਾਰੀ ਕਰਕੇ ਹੋਣ ਵਾਲੇ ਨੁਕਸਾਨ ਲਈ ਉਹਨਾਂ ਨੂੰ ਕੈਲਸ਼ੀਅਮ ਦੇ ਹੀ ਟੀਕੇ ਕੈਲਸ਼ੀਅਮ ਲਿਕਵਡ ਵਿੱਚ ਦਿੱਤਾ ਜਾਂਦਾ ਹੈ ਅਤੇ ਘਰੇਲੂ ਇਲਾਜ ਅਸੀਂ ਕਹੀਏ ਤਾਂ ਉਹਦੇ ਵਿੱਚ ਅਲਸੀ ਦੀ ਤੇਲ ਅਲਸੀ ਦੀ ਖਲ੍ਹ ਵੜੇਵਿਆਂ ਦੀ ਖਲ੍ਹ ਡਾਲਡਾ ਘਿਓ ਅਤੇ ਗੁੜ ਅਜਵਾਈਨ ਤੇਲ ਦੇ ਵਿੱਚ ਮਿਕਸ ਕਰਕੇ ਗਾਵਾਂ ਨੂੰ ਦੇ ਸਕਦੇ ਹਾਂ ਜਿਸ ਨਾਲ ਉਹਨਾਂ ਦੀ ਕੈਲਸ਼ੀਅਮ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ ਦੁੱਧ ਘੱਟ ਜਾਣ 'ਤੇ ਇਹ ਸਾਰੀਆਂ ਚੀਜ਼ਾਂ ਗਾਵਾਂ ਨੂੰ ਦਿੱਤੀਆਂ ਜਾਂਦੀਆਂ ਹਨ